ਹਾਂਜੀ ਸਤਿ ਸ਼੍ਰੀ ਅਕਾਲ ਜੀ

ਠੀਕ ਹੈ ਜੀ ਨਵੇਂ ਪਹਿਲਾਂ ਜਿੰਮ ਕਰੀ ਆ ਜਾਂ ਨਵੇਂ ਹੋ ਅੱਛਾ ਜੀ ਬਰਦਰ ਜਿੰਮ ਮੇਰੀ ਰਾਮਾ ਰੋਡ ਭਿੱਖੀ ਹਾਂ ਅਤੇ ਤੁਸੀਂ ਸਵੇਰ ਦੇ ਟਾਈਮ ਵੀ ਆ ਸਕਦੇ ਹੋ ਸ਼ਾਮ ਦੇ ਟਾਈਮ ਵੀ ਆ ਸਕਦੇ ਹੋ ਤੁਸੀਂ ਵੇਟ ਥੋੜ੍ਹਾ ਮੈਨੂੰ ਦੱਸ ਦੋਗੇ ਆਪਣੀ ਫਿਜਿਕਸ ਬਾਰੇ ਵੇਟ ਲੋਸ ਕਰਨਾ ਜਾਂ ਗੇਨ ਕਰਨਾ

ਓਕੇ ਹਾਂ ਫਿਰ ਤੁਸੀਂ ਨਾ ਮੋਰਨਿੰਗ ਟਾਈਮ ਅਗਰ ਆ ਸਕਦੇ ਤਾਂ ਜ਼ਿਆਦਾ ਵਧੀਆ ਹਾਂ ਉਸ ਦੇ ਨਾਲ ਨਾ ਆਪਣਾ ਪੇਟ ਖਾਲੀ ਹੁੰਦਾ ਅਤੇ ਤੁਹਾਨੂੰ ਵੇਟ ਘੱਟ ਕਰਨ ਦੇ ਵਿੱਚ ਆਸਾਨੀ ਹੋਵੇਗੀ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਡਾਇਟ ਚਾਰਟ ਬਣਾ ਕੇ ਦੇ ਦਾਂਗੇ ਬਕਾਇਦਾ ਤੌਰ 'ਤੇ ਸਾਡੀ ਜਿੰਮ ਦੀ ਇਹ ਫਸਿਲਟੀ ਹੈ ਵੀ ਜੋ ਵੀ ਕੋਈ ਮੈਂਬਰ ਆਉਂਦਾ ਉਸਨੂੰ ਉਸਦੇ ਬਾਡੀ ਵੇਟ ਦੇ ਹਿਸਾਬ ਨਾਲ ਹੀ ਔਰ ਐਕਸਰਸਾਈਜ਼ ਦੇ ਹਿਸਾਬ ਨਾਲ ਅਸੀਂ ਡਾਇਟ ਚਾਰਟ ਵਗੈਰਾ ਬਣਾ ਕੇ ਦੇ ਦਿੰਦੇ ਹਾਂ ਫੁੱਲੀ ਏਸੀ ਜਿੰਮ ਹੈ ਔਰ ਹਾਂ ਤੁਸੀਂ ਆ ਕੇ ਜਿਮ ਦੇਖੋ ਅਤੇ ਆ ਕੇ ਫਿਰ ਮਿਲ ਕੇ ਗੱਲ ਕਰਦੇ ਹਾਂ ਫਿਰ ਓਕੇ ਬਾਏ ਜੀ